ਹੈਲੋ ਸਰ ਮੈਂ ਸੁਖਬੀਰ ਸਿੰਘ ਬੋਲ ਰਿਹਾ ਹਾਂ ਅੱਜ ਮੇਰਾ ਜਨਮ ਦਿਨ ਹੈ ਮੈਂ ਆਪਣੇ ਘਰ ਵਿੱਚ ਇੱਕ ਪਾਰਟੀ ਰੱਖੀ ਹੋਈ ਹੈ ਇਸ ਪਾਰਟੀ ਵਿੱਚ ਮੇਰੇ ਮਿੱਤਰ ਅਤੇ ਰਿਸ਼ਤੇਦਾਰ ਆ ਰਹੇ ਹਨ ਮੇਰੇ ਕੁਝ ਮਿੱਤਰ ਅੰਮ੍ਰਿਤਸਰ ਤੋਂ ਆ ਰਹੇ ਹਨ ਉਹਨਾਂ ਨੂੰ ਰਾਣਾ ਸਵੀਟਸ ਦਾ ਪਿੱਜ਼ਾ ਬਹੁਤ ਪਸੰਦ ਹੈ ਇਸ ਲਈ ਤੁਸੀਂ ਅੱਠ ਬਰਗਰ ਅਤੇ ਤਿੰਨ ਡਬਲ ਪੀਜ਼ਾ ਭੇਜ ਦਿਓ ਮੇਰੇ ਮਾਸੀ ਜੀ ਜੋ ਲੁਧਿਆਣਾ ਤੋਂ ਆ ਰਹੇ ਹਨ ਉਹਨਾਂ ਨੂੰ ਤੁਹਾਡੇ ਹੋਟਲ ਦਾ ਦਾਲ ਮੱਖਣੀ ਬਹੁਤ ਪਸੰਦ ਹੈ ਇਸ ਲਈ ਉਹਨਾਂ ਲਈ ਦੋ ਪਲੇਟ ਦਾਲ ਮੱਖਣੀ ਭੇਜ ਦਿਓ ਇਸ ਦੇ ਨਾਲ ਹੀ ਮੇਰੇ ਜਨਮ ਦਿਨ ਦਾ ਕੇਕ ਵੀ ਤਿਆਰ ਕਰ ਦਿੱਤਾ ਜਾਵੇ ਜਿਸ 'ਤੇ ਮੇਰਾ ਨਾਮ ਲਿਖ ਦਿੱਤਾ ਜਾਵੇ ਅਤੇ ਮੈਂ ਤੁਹਾਨੂੰ ਉਸ ਕੇਕ ਦੀ ਫੋਟੋ ਭੇਜ ਦਿੰਦਾ ਹਾਂ ਤੁਸੀਂ ਉਸ ਤਰ੍ਹਾਂ ਦਾ ਹੀ ਕੇਕ ਤਿਆਰ ਕਰਕੇ ਭੇਜ ਦਿਓ ਮੇਰਾ ਪਤਾ ਅਜੀਤ ਨਗਰ ਗਲੀ ਨੰਬਰ ਤਿੰਨ ਰਾਇਕੇ ਕਲਾ ਜ਼ਿਲ੍ਹਾ ਬਠਿੰਡਾ ਹੈ ਕਿਰਪਾ ਕਰਕੇ ਮੇਰਾ ਆਰਡਰ ਇਸ ਪਤੇ 'ਤੇ ਸਮੇਂ ਸਿਰ ਪਹੁੰਚਾ ਦਿੱਤਾ ਜਾਵੇ ਆਪ ਜੀ ਦੀ ਬਹੁਤ ਬਹੁਤ ਮਿਹਰਬਾਨੀ ਹੋਵੇਗੀ ਧੰਨਵਾਦ